ਮੈਂ ਬਾਰ੍ਹਾਂ ਸਾਲਾਂ ਦੀ ਉਮਰ ਵਿੱਚ ਆਪਦੀ ਮੰਮੀ ਤੋਂ ਕੰਮ ਸਿੱਖੇ ਸਿਲਾਈ ਕਢਾਈ ਦਾ ਕੰਮ ਮੇਰੀ ਮੰਮੀ ਨੂੰ ਬਹੁਤ ਜ਼ਿਆਦਾ ਆਉਂਦਾ ਸੀ ਉਹ ਬਾਹਰਲੇ ਕੰਮ ਵੀ ਫੜਦੀ ਹੁੰਦੀ ਸੀ ਅਤੇ ਮੈਂ ਉਹਨਾਂ ਨੂੰ ਦੇਖ ਦੇਖ ਕੇ ਇਹ ਕੰਮ ਸਿੱਖਣ ਲੱਗ ਪਈ ਅਤੇ ਫੇਰ ਮੈਂ ਸਾਰੇ ਕੰਮ ਆਪ ਵੀ ਕਰਨ ਲੱਗ ਗਈ ਫੇਰ ਪੜ੍ਹਾਈ ਲਿਖਾਈ ਵਿੱਚ ਇੰਟਰਸਟ ਨਹੀਂ ਬਣਿਆ ਅਤੇ ਮੈਂ ਸਾਰਾ ਕੰਮ ਸਿਲਾਈ ਦਾ ਸਿੱਖ ਲਿਆ ਅਤੇ ਮੰਮੀ ਨੇ ਮੇਰੀ ਨੇ ਸਾਰਾ ਕੰਮ ਸਿਲਾਈ ਕਢਾਈ ਬੁਣਾਈ ਕਰੋਸ਼ੀਆ ਸਿਲਾਈ ਦਾ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ ਫਿਰ ਮੈਂ ਹੌਲੀ ਹੌਲੀ ਸਾਰਾ ਕੰਮ ਸਿੱਖਦੀ ਗਈ ਇੰਨੇ ਨਾਲ ਮੈਨੂੰ ਬਾਹਰਲੇ ਕੰਮ ਆਉਣੇ ਸ਼ੁਰੂ ਹੋ ਗਏ ਅਤੇ ਮੈਂ ਹੌਲੀ ਹੌਲੀ ਬਾਹਰਲਾ ਕੰਮ ਵੀ ਫੜਨਾ ਸ਼ੁਰੂ ਕਰ ਦਿੱਤਾ ਮੈਨੂੰ ਕਢਾਈ ਵਿੱਚ ਇੰਟਰਸਟ ਹੋ ਗਿਆ ਫੇਰ ਮੈਂ ਚੁੰਨੀਆਂ ਅਤੇ ਸੂਟਾਂ ਦੀ ਕਢਾਈ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਹਰਲੇ ਓਰਡਰ ਲੈਣੇ ਸ਼ੁਰੂ ਕਰ ਦਿੱਤੇ ਇੰਨੇ ਨਾਲ ਮੇਰਾ ਕੰਮ ਕਾਰ ਵੱਧਦਾ ਰਿਹਾ ਹੌਲੀ ਹੌਲੀ ਇਹ ਤੋਂ ਵਧਾਉਂਦੇ ਗਏ ਬਾਹਰਲੇ ਕੰਮ ਫੜਦੀ ਗਈ ਅਤੇ ਚੁੰਨੀਆਂ ਦਾ ਕੰਮ ਜ਼ਿਆਦਾ ਮੇਰਾ ਹੋਣਾ ਸ਼ੁਰੂ ਹੋ ਗਿਆ ਇੰਨੇ ਨਾਲ ਅਸੀਂ ਸਾਰਾ ਪਰਿਵਾਰ ਇਹਨਾਂ ਕੰਮਾਂ ਵਿੱਚ ਪੈ ਗਏ ਅਤੇ ਮੇਰੀ ਮਦਦ ਕਰਨ ਨੀ ਸ਼ੁਰੂ ਕਰ ਦਿੱਤੀ ਮੇਰੀਆਂ ਭਰਜਾਈਆਂ ਨੇ ਵੀ ਮੇਰਾ ਸਾਥ ਦਿੱਤਾ ਅਤੇ ਮੈਂ ਮੈਂ ਇਸ ਕੰਮ ਵਿੱਚ ਅੱਗੇ ਵਧੀ ਅਤੇ ਪਰਿਵਾਰ ਨੇ ਪਰਿਵਾਰ ਇਹਨਾਂ ਕੰਮਾਂ ਵਿੱਚ ਅੱਗੇ ਵਧਦੀ ਰਹੀ ਅਤੇ ਮੈਂ ਬੁਣਾਈ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਅਤੇ ਦਰੀਆਂ ਵੀ ਬਣਾਈਆਂ ਖੱਡੀ ਦਾ ਕੰਮ ਕੀਤਾ ਤਾਣੀਆਂ ਬਣਾਈਆਂ ਅਤੇ ਫੇਰ ਉਹ ਤੋਂ ਬਾਅਦ ਮੇਰੀ ਮਾਤਾ ਨੇ ਮੈਨੂੰ ਪੇਂਟਿੰਗ ਦਾ ਕੰਮ ਕਰਨਾ ਸ਼ੁਰੂ ਕਰਾ ਦਿੱਤਾ ਅਤੇ ਮੈਂ ਹੌਲੀ ਹੌਲੀ ਪੇਂਟਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਦੇ ਸੂਟ ਬਣਾਉਣੇ ਸ਼ੁਰੂ ਕਰ ਦਿੱਤੇ ਲੋਕਾਂ ਨੂੰ ਪਸੰਦ ਆਉਣ ਲੱਗ ਪਏ ਅਤੇ ਲੋਕਾਂ ਨੇ ਮੈਨੂੰ ਓਰਡਰ ਦੇਣਾ ਸ਼ੁਰੂ ਕਰ ਦਿੱਤਾ ਇੰਨੇ ਨਾਲ ਮੈਂ ਅੱਗੇ ਵਧਦੀ ਰਹੀ ਅਤੇ ਪੈਸੇ ਆਉਣ ਲੱਗ ਪਏ ਅਤੇ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ ਇਸ ਇਹ